ਇੱਕ ਵਾਰ ਮੈਂ ਆਪਣੇ ਮੁੰਡੇ ਨਾਲ ਸਕੂਟਰ 'ਤੇ ਜਾਂਦੀ ਵੀ ਸੀ ਰਸਤੇ 'ਚ ਮੈਂ ਦੇਖਿਆ ਸੜਕ ਦੇ ਕੰਢੇ ਦੇ ਉੱਤੇ ਜੰਗਲ ਹੀ ਸੀ ਉੱਥੇ ਇੱਕ ਕਬੂਤਰ ਸੀ ਉਹ ਤਾਰ ਦੇ ਨਾਲ ਲਟਕਿਆ ਹੋਇਆ ਸੀ ਕਰੰਟ ਖਾ ਕੇ ਅਸੀਂ ਫਿਰ ਉਹਨੂੰ ਦੇਖ ਕੇ ਰੁਕ ਗਏ ਅਤੇ ਉਹਨੂੰ ਲੱਕੜ ਦੇ ਨਾਲ ਜਾਂ ਕਿਸੇ ਵੀ ਚੀਜ਼ ਦੇ ਨਾਲ ਉਹਨੂੰ ਉ ਲਾਹਇਆ ਬੜੀ ਮੁਸ਼ਕਿਲ ਦੇ ਨਾਲ ਉਹਨੂੰ ਥੱਲੇ ਲਾਹਇਆ ਫਿਰ ਉਹਨੂੰ ਅਸੀਂ ਪਾਣੀ ਪਿਲਾਇਆ ਪਾਣੀ ਪਿਲਾ ਕੇ ਉਹਨੂੰ ਕੋਈ ਜਿਹੜੇ ਜਾਨਵਰਾਂ ਵਾਲੇ ਡਾਕਟਰ ਨੇ ਉਹਦੇ ਕੋਲ ਲੈ ਗਏ ਅਸੀਂ ਉਹਦਾ ਇਲਾਜ ਇਲੂਜ ਕਰਵਾਇਆ ਅਤੇ ਉਹ ਠੀਕ ਹੋ ਗਿਆ ਫਿਰ ਅਸੀਂ ਉਹਨੂੰ ਦਾਣਾ ਦੂਣਾ ਚੁਗਾਇਆ ਅਤੇ ਉਹਨੂੰ ਘਰ ਲੈ ਆਏ ਘਰ ਲਿਆ ਕੇ ਫਿਰ ਉਹਦੀ ਦੇਖਭਾਲ ਕੀਤੀ ਫਿਰ ਅਸੀਂ ਮਤਲਬ ਦੇਖਿਆ ਇੱਕ ਦੋ ਦਿਨਾਂ ਤੱਕ ਜਦੋਂ ਉਹ ਠੀਕ ਹੋ ਗਿਆ ਚੋਗਾ ਚੁਗਾ ਪਾਉਂਦੇ ਰਹੇ ਪਾਣੀ ਪੂਣੀ ਪਿਆਉਂਦੇ ਰਹੇ ਉਹਨੂੰ ਚੰਗੀ ਤਰ੍ਹਾਂ ਜਿਹੜੀ ਡਾਕਟਰ ਨੇ ਇਲਾਜ ਸੀ ਉਹਦਾ ਕਰਾਵਾਉਂਦੇ ਦੇ ਦੋ ਚਾਰ ਵਾਰ ਲੈ ਕੇ ਗਏ ਫਿਰ ਉਹ ਬਿਲਕੁਲ ਠੀਕ ਹੋ ਗਿਆ ਤਾਂ ਅਸੀਂ ਫਿਰ ਉਹਨੂੰ ਉੱਥੇ ਹੀ ਜਿੱਥੇ ਜੰਗਲ ਤੋਂ ਉਹਨੂੰ ਫੜ ਕੇ ਲਿਆਏ ਸੀ ਅਤੇ ਉੱਥੇ ਹੀ ਅਸੀਂ ਉਹਨੂੰ ਫਿਰ ਛੱਡ ਕੇ ਆ ਗਏ